ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਦੇਖੋ ਜੀ ਬਾਰਿਸ਼ ਦੇ ਨਾਲ ਝੱਖੜ ਵੀ ਬਹੁਤ ਤੇਜ਼ ਸੀਗਾ ਅਤੇ ਜਿਸ ਕਾਰਨ ਜੋ ਦਰਖਤਾਂ ਦਾ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਗਾ ਆਪਣੇ ਖੇਤਾਂ ਦੇ ਵਿੱਚ ਵੀ ਦਰਖਤ ਨੇ ਜੋ ਟੁੱਟੇ ਨੇ ਅਤੇ ਸੜਕਾਂ ਦੇ ਉੱਪਰ ਵੀ ਦਰਖਤ ਟੁੱਟੇ ਨੇ ਸੜਕਾਂ ਦੇ ਉੱਪਰ ਦਰਖਤ ਟੁੱਟਣ ਕਾਰਨ ਆਵਾਜਾਈ ਨੂੰ ਆਵਾਜਾਈ ਦਾ ਵੀ ਬਹੁਤ ਨੁਕਸਾਨ ਹੋਇਆ ਜੀ ਆਵਾਜਾਈ ਦੇ ਵਿੱਚ ਵਿਘਨ ਪਿਆ ਗਾ ਦਰਖਤ ਟੁੱਟਣ ਕਰਕੇ ਕਾਫੀ ਥਾਵਾਂ 'ਤੇ ਬਿਜਲੀ ਵਾਲੇ ਖੰਬੇ ਵੀ ਟੁੱਟੇ ਨੇ ਦਰਖਤ ਡਿੱਗਣ ਕਰਕੇ ਉਹਨਾਂ ਕਰਕੇ ਸਾਨੂੰ ਬਿਜਲੀ ਦੀ ਸਮੱਸਿਆ ਵੀ ਆਈ ਹੈ ਹਾਂਜੀ ਅਸਲੀ ਨੁਕਸਾਨ ਅਸਲੀ ਨੁਕਸਾਨ ਤਾਂ ਜੀ ਦੇਖੋ ਕੋਈ ਕਣਕ ਦਾ ਜੋ ਨੁਕਸਾਨ ਹੈ ਜੀ ਉਹ ਹੋਇਆ ਹੈਗਾ ਉਹ ਮਤਲਬ ਕਣਕ ਵੱਢਣ 'ਤੇ ਸੀਗੀ ਅਤੇ ਉਹ ਕਣਕਾਂ ਡਿਗ ਪਈਆਂ ਜੀ ਉਹ ਜੀ ਆਪਾਂ ਕਹਿ ਸਕਦੇ ਹਾਂ ਵੀ ਪੈਂਤੀ ਤੋਂ ਚਾਲ੍ਹੀ ਪਰਸੈਂਟ ਜੋ ਕਣਕ ਦਾ ਝਾੜ ਡਿੱਗਆ ਗਾ ਹਾਂਜੀ ਕਿਉਂਕਿ ਕਣਕਾਂ ਝੱਖੜ ਜ਼ਿਆਦਾ ਸੀ ਮੀਂਹ ਸੀਗਾ ਉਹ ਫਸਲਾਂ ਡਿੱਗ ਪਈਆਂ ਨੇ ਅਤੇ ਉਪਰੋਂ ਮੀਂਹ ਪੈ ਗਿਆ ਠੀਕ ਹੈ ਜੀ ਉਹਦੇ ਕਾਰਨ ਉਹ ਬਿਲਕੁਲ ਜੋ ਦਾਣਾ ਖਰਾਬ ਹੋਣ ਲੱਗ ਗਏ ਅਤੇ ਉਹ ਮੀਂਹ ਕਰਕੇ ਜੀ ਹੁਣ ਉਹ ਵਢਾਈ ਦਾ ਕੰਮ ਆ ਜਿਹੜਾ ਉਹ ਵੀ ਪੰਦਰਾਂ ਦਿਨ ਵੀਹ ਲੇਟ ਹੋ ਗਿਆ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਜੀ ਮੀਂਹ ਤੋਂ ਪਹਿਲਾਂ ਝੱਖੜ ਕਾਰਨ ਇੱਕ ਦੋ ਥਾਵਾਂ 'ਤੇ ਅੱਗ ਜ਼ਰੂਰ ਲੱਗੀ ਹੈ ਉਹ ਅੱਗ ਲੱਗਣ ਕਰਕੇ ਉੱਥੇ ਨੇੜੇ ਤੇੜੇ ਦੇ ਦਸ ਬਾਰ੍ਹਾਂ ਏਕੜ ਦੇ ਵਿੱਚ ਕਣਕ ਦਾ ਨੁਕਸਾਨ ਹੋਇਆ ਅਤੇ ਉਹ ਮਾਲੀ ਨੁਕਸਾਨ ਉਨਾਂ ਕੁ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਜ਼ਿਆਦਾ ਹਾਂਜੀ ਉਹ ਇੱਕ ਘਰ ਦੇ ਸੀ ਬਾਰ੍ਹਾਂ ਪੰਦਰ੍ਹਾਂ ਕਿੱਲੇ ਅਤੇ ਉਹ ਦੇਖੋ ਜੀ ਕੁਦਰਤੀ ਆਫਤ ਦਾ ਪ੍ਰਬੰਧ ਤਾਂ ਔਖਾ ਪਰ ਹਾਂ ਜੋ ਨੁਕਸਾਨ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਗਾ ਉਹਦੀ ਭਰਪਾਈ ਦੇ ਲਈ ਸਰਕਾਰ ਨੂੰ ਜ਼ਰੂਰ ਕਦਮ ਚੁੱਕਣੇ ਚਾਹੀਦੇ ਨੇ ਜਿਵੇਂ ਹੁਣ ਉਹ ਕਣਕ ਦਾ ਨੁਕਸਾਨ ਹੋਇਆ ਜੀ ਉਹਨਾਂ ਦਾ ਭਰਪਾਈ ਦੇ ਲਈ ਹੋਣੇ ਚਾਹੀਦੇ ਨੇ ਇੰਤਜ਼ਾਮ ਹੋਣੇ ਚਾਹੀਦੀ ਹਾਂਜੀ ਹਾਂਜੀ

ਧੰਨਵਾਦ ਧੰਨਵਾਦ ਜੀ